ਮੈਂ ਕਿਸੇ ਵੀ ਸੰਗਰੀ ਨੂੰ ਸਿੱਖਣ ਜਾਂ ਅਭਿਆਸ ਕਰਨ ਲਈ ਬੁਨਾਈ ਦੇ ਪੈਟਰਨ ਜਾਂ ਕਿਸੇ ਹੋਰ ਕਲਾ ਦੀਆਂ ਜਾਣਕਾਰੀਆਂ ਨਹੀਂ ਸਿੱਖ ਸਕਦੀ ਕਿਉਂਕਿ ਮੈਂ ਕੰਪਿਊਟਰ ਪ੍ਰੋਗਰਾਮ ਹਾਂ ਹਾਲਾਂਕਿ ਜੇ ਤੁਸੀਂ ਬੁਨਾਈ ਦੇ ਪੈਟਰਨ ਸਿੱਖਣਾ ਚਾਹੁੰਦੇ ਹੋ ਤਾਂ ਕੁਝ ਪ੍ਰਮੁੱਖ ਸਰੋਤ ਹਨ ਇਸ ਵਿੱਚ ਮਦਦ ਕਰ ਸਕਦੇ ਹਨ ਯੂਟੀਊਬ ਬੁਨਾਈ ਦੇ ਪੈਟਰਨ ਸਿੱਖਣ ਲਈ ਯੂਟੀਊਬ ਇੱਕ ਸ਼ਾਨਦਾਰ ਸਰੋਤ ਹੈ ਇਹ ਇੱਥੇ ਤੁਹਾਨੂੰ ਹਰ ਤਰ੍ਹਾਂ ਦੇ ਪੈਟਰਨ ਅਤੇ ਤਕਨੀਕਾਂ ਸਿੱਖਣ ਵਾਲੇ ਵੀਡੀਓਜ ਮਿਲਦੇ ਹਨ ਕੁਛ ਪ੍ਰਸਿੱਧ ਚੈਨਲ ਹਨ ਦੀ ਕਰੋਸ਼ੀਆ ਮਿਕੀ ਕਰੋਸ਼ੀਆ ਸਿੰਪਲੀ ਔਕਡ ਬਾਏ ਜੈਨਟ ਕਿਤਾਬਾਂ ਬੁਨਾਈ ਦੇ ਪੈਟਰਨ ਸਿੱਖਣ ਲਈ ਕਿਤਾਬਾਂ ਵੀ ਬਹੁਤ ਮਦਦਗਾਰ ਹੁੰਦੀਆਂ ਹਨ ਕੁਛ ਮਸ਼ਹੂਰ ਕਿਤਾਬਾਂ ਜੋ ਖਾਸ ਤੌਰ 'ਤੇ ਪੈਟਰਨ ਪ੍ਰਦਾਨ ਕਰਦੀਆਂ ਹਨ ਵੈਬਸਾਈਟਾਂ ਅਤੇ ਬਲਾਗਸ ਇੰਟਰਨੈਟ 'ਤੇ ਕਈ ਵੈਬਸਾਈਟਾਂ ਹਨ ਜਿੱਥੇ ਤੁਸੀਂ ਮਿਆਰੀ ਅਤੇ ਉਤਪਾਦਕ ਪੈਟਰਨ ਪ੍ਰਾਪਤ ਕਰ ਸਕਦੇ ਹੋ ਰੈਵਲਰੀ ਇਹ ਪੈਟਰਨਾਂ ਦੀਆਂ ਇੱਕ ਵੱਡੀਆਂ ਡੇਟਾਬੇਸ ਹਨ ਜਿੱਥੇ ਤੁਸੀਂ ਮੁਫਤ ਅਤੇ ਪੈਸੇ ਵਾਲੇ ਪੈਟਰਨ ਲੱਭ ਸਕਦੇ ਹੋ ਇੱਥੇ ਬੁਨਾਈ ਦੇ ਪੈਟਰਨ ਅਤੇ ਸਿਖਲਾਈ ਵੀਡੀਓਜ਼ ਦੇ ਹਰ ਨਾਲ ਨਾਲ ਬੁਨਾਈ ਲਈ ਖਾਸ ਚੁਣੀਆਂ ਗਈਆਂ ਰਣਨੀਤੀਆਂ ਵੀ ਮਿਲਦੀਆਂ ਹਨ ਕਈ ਵਾਰੀ ਸਥਾਨਕ ਕਲਾਸਾਂ ਅਤੇ ਵਰਕਸ਼ਾਪਾਂ ਵਿੱਚ ਸ਼ਾਮਿਲ ਹੋਣਾ ਵੀ ਬਹੁਤ ਲਾਭਦਾਇਕ ਹੋ ਸਕਦਾ ਹੈ ਇੱਥੇ ਤੁਹਾਨੂੰ ਸਿੱਧਾ ਗੁਰ ਜਾਂ ਬੁਨਾਈ ਦੇ ਮਾਹਿਰਾਂ ਤੋਂ ਸਿੱਖਣ ਦਾ ਮੌਕਾ ਮਿਲਦਾ ਹੈ ਸੋਸ਼ਲ ਮੀਡੀਆ ਇੰਸਟਾਗਰਾਮ ਫੇਸਬੁਕ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ 'ਤੇ ਵੀ ਬੁਨਾਈ ਦੇ ਪੈਟਰਨ ਦੀਆਂ ਕਈ ਕਮਿਊਨਿਟੀਆਂ ਮਿਲਦੀਆਂ ਹਨ